ਡਿਜ਼ੀਟਲ ਐਪ ਨੇ ਭਾਰਤ ਵਿੱਚ ਆਪਣਾ ਵਪਾਰ ਵਧੀਆ ਕੀਤਾ ਹੋਇਆ ਪਰ ਇਸ ਡਿਜ਼ੀਟਲ ਐਪ ਦੇ ਸਾਨੂੰ ਕੁਛ ਨੁਕਸਾਨ ਵੀ ਹਨ ਕਿਉਂਕਿ ਕੁਛ ਟਾਇਮ ਪਹਿਲੇ ਮੈਂ ਆਪਣੇ ਪੈਸੇ ਮਤਲਬ ਇਹ ਸਹਾਰਾ ਡਿਜ਼ੀਟਲ ਐਪ ਵਿੱਚ ਲਾਏ ਸੀ ਅਤੇ ਬਾਅਦ 'ਚ ਪਤਾ ਲੱਗਿਆ ਇਹ ਕੰਪਨੀ ਫਰੋਡ ਹੈ ਅਤੇ ਇਸ ਕੰਪਨੀ ਨੇ ਜਿਹੜੇ ਅਸੀਂ ਪੈਸੇ ਲਾਏ ਸੀ ਉਹ ਸਾਨੂੰ ਨਹੀਂ ਮਿਲੇ ਅਤੇ ਕੰਪਨੀ ਉਹ ਪੈਸੇ ਲੈ ਕੇ ਭੱਜ ਗਈ ਕਿਰਪਾ ਕਰਕੇ ਇਹੋ ਜਿਹੇ ਡਿਜ਼ੀਟਲ ਐਪ ਨੂੰ ਭਾਰਤ ਵਿੱਚੋਂ ਬੈਨ ਕਰਨਾ ਚਾਹੀਦਾ ਤਾਂ ਕਿ ਕੱਲ੍ਹ ਨੂੰ ਕਿਸੇ ਦੀ ਜਿਸ ਨੇ ਆਪਣੀ ਮਤਲਬ ਕਮਾਈ ਇਹਦੇ ਵਿੱਚ ਲਾਈ ਹੁੰਦੀ ਹੈ ਉਹਨੂੰ ਨੁਕਸਾਨ ਨਾ ਹੋਵੇ